ਮੈਨੂੰ ਗਾਉਣਾ ਬਹੁਤ ਪਸੰਦ ਹੈ ਮਤਲਬ ਮੇਰੀ ਜ਼ਿੰਦਗੀ ਗਾਉਣ ਨਾਲ ਹੈ ਮੈਂ ਆਪਣੀ ਇਸ ਲਈ ਕਿ ਗਾਇਕੀ ਦਾ ਰਿਆਜ਼ ਅਤੇ ਅਭਿਆਸ ਬਹੁਤ ਜ਼ਰੂਰੀ ਹੈ ਤੋ ਮੈਂ ਸਵੇਰੇ ਉੱਠ ਕੇ ਸੁਬਹਾ ਜਿਵੇਂ ਘੰਟਾ ਮੈਂ ਆਪਣੀ ਗਾਇਕੀ ਦਾ ਰਿਆਜ਼ ਕਰਦੀ ਹਾਂ ਉਸ ਤੋਂ ਬਾਅਦ ਕੀ ਹੈ ਜੋ ਵੀ ਆਪਣਾ ਮਤਲਬ ਦਿਨ ਚਰਿਆ ਹੁੰਦੀ ਹੈ ਜੋ ਮੇਰੀ ਉਹ ਚੱਲਦੀ ਹੈ ਉਸ ਤੋਂ ਬਾਅਦ ਸ਼ਾਮ ਨੂੰ ਕੀ ਹੈ ਸ਼ਾਮ ਨੂੰ ਜੋ ਵੀ ਮੈਂ ਸੁਬਹਾ ਰਿਆਜ਼ ਕੀਤਾ ਹੁੰਦਾ ਹੈਗਾ ਉਹਦਾ ਕੀ ਹੈ ਹਾਰਮੋਨੀਅਮ 'ਤੇ ਜਾਂ ਫਿਰ ਇੱਕ ਮੇਰੇ ਕੋਲ ਇੱਕ ਛੋਟੀ ਜਿਹੀ ਗਿਟਾਰ ਹੈ ਠੀਕ ਹੈ ਉਹਦੇ 'ਤੇ ਉਹਦਾ ਕੀ ਹੈ ਅਭਿਆਸ ਕਰਨਾ ਹੁੰਦਾ ਹੈਗਾ ਸੁਰ ਲਗਾਉਣੇ ਹੁੰਦੇ ਹੈਗੇ ਜੋ ਮੈਂ ਸੁਬਹਾ ਸਿੱਖਿਆ ਹੁੰਦਾ ਹੈਗਾ ਠੀਕ ਹੈ ਜੋ ਮੈਂ ਆਪਣੇ ਗੁਰੂ ਤੋਂ ਸਿੱਖਿਆ ਹੁੰਦਾ ਹੈਗਾ ਠੀਕ ਹੈ ਉਹਦਾ ਕੀ ਹੈ ਵਾਰ ਵਾਰ ਅਭਿਆਸ ਕਰਨਾ ਹੁੰਦਾ ਹੈਗਾ ਉਹਨਾਂ ਨੂੰ ਗਾ ਕੇ ਸੁਣਾਉਣਾ ਹੁੰਦਾ ਹੈਗਾ ਕਿ ਕਿੱਦਾਂ ਮੈਂ ਆਪਣਾ ਰਿਆਜ਼ ਕੀਤਾ ਕਿੱਦਾਂ ਮੈਂ ਆਪਣੀ ਅਭਿਆਸ ਕੀਤੀ ਹੈਗੀ ਆ ਅਤੇ ਜਦੋਂ ਮਤਲਬ ਕਹਿ ਦਿੰਦੇ ਹੈਗੇ ਵੀ ਸਹੀ ਹੈ ਜਦੋਂ ਤਕ ਉਹ ਨਹੀਂ ਕਹਿੰਦੇ ਕਿ ਸਹੀ ਹੈ ਉਦੋਂ ਤੱਕ ਮੈਂ ਉਹਦਾ ਅਭਿਆਸ ਕਰਦੀ ਰਹਿੰਦੀ ਹਾਂ ਕਰਦੇ ਰਹਿੰਦੇ ਇਸ ਤਰ੍ਹਾਂ ਮੈਂ ਆਪਣੀ ਗਾਇਕੀ ਨੂੰ ਸੁਧਾਰ ਰਹੀ ਹਾਂ